ਹਾਂਜੀ ਟੈਕਨੋਲੋਜੀ ਨੇ ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਕਿਉਂ ਕਿਉਂਕਿ ਟੈ ਟੈਕਨੋਲੋਜੀ ਦੀ ਹੈਲਪ ਨਾਲ ਜਿਵੇਂ ਕਿ ਹੋ ਗਈ ਯੂਟਿਊਬਸ ਹੋ ਗਏ ਰਿਕਸ਼ਾ ਪੋਰਟਲਸ ਹੋ ਗਏ ਐੱਨ ਸੀ ਆਰ ਸੀ ਵੈਬਸਾਈਟਸ ਹੋ ਗਈਆਂ ਹੈ ਨਾ ਐੱਨ ਸੀ ਆਰ ਸੀ ਵੈਬਸਾਈਟਸ ਤੋਂ ਆਪਾਂ ਬੁੱਕਸ ਡਾਊਨਲੋਡ ਕਰ ਸਕਦੇ ਹਾਂ ਨੋਟਸ ਡਾਊਨਲੋਡ ਕਰ ਸਕਦੇ ਹਾਂ ਪੂਰੀ ਦੀ ਪੂਰੀ ਬੁੱਕ ਖੁੱਲ੍ਹ ਜਾਂਦੀ ਹੈ ਜਿਵੇਂ ਕਿ ਹੁਣ ਆਪਾਂ ਨੇ ਕਈ ਵਾਰ ਨਹੀਂ ਕੋਈ ਬੁੱਕ ਪਰਚੇਜ ਕਰਨੀ ਤਾਂ ਅਸੀਂ ਵੈਬਸਾਈਟ ਤੋਂ ਡਾਊਨਲੋਡ ਕਰਕੇ ਪੂਰੇ ਨੋਟਸ ਕੋਪੀ ਕਰ ਸਕਦੇ ਹਾਂ ਲਿਖ ਸਕਦੇ ਹਾਂ ਪੜ੍ਹ ਸਕਦੇ ਹਾਂ ਸਾਡੀ ਮਰਜ਼ੀ ਹੈ ਅਸੀਂ ਕੁਛ ਵੀ ਕਰ ਸਕਦੇ ਹਾਂ ਯੂਟਿਊਬ ਤੋਂ ਵੀ ਜਿਵੇਂ ਆਪਾਂ ਨੂੰ ਕੋਈ ਵੀ ਵੀਡੀਓਸ ਡਾਊਨਲੋਡ ਕਰ ਲਉ ਉਹਨੂੰ ਸੁਣ ਲਉ ਤਾਂ ਅਸੀਂ ਅੱਗੇ ਨੂੰ ਪੜ੍ਹਾਉਣ 'ਚ ਮਦਦ ਮਿਲਦੀ ਹੈ ਠੀਕ ਹੈ ਆਪਾਂ ਪੜ੍ਹਾ ਸਕਦੇ ਹਾਂ ਐਵੇਂ ਹੀ ਕੋਈ ਵੀ ਜਿਵੇਂ ਰਿਕਸ਼ਾ ਪੋਰਟਲ ਹੈ ਹੋ ਗਿਆ ਸੈਟੇਲਾਈਟਸ ਹੋ ਗਏ ਤਾਂ ਸਾਨੂੰ ਇੱਥੋਂ ਕਾਫੀ ਜ਼ਿਆਦਾ ਨੋਲੇਜ ਮਿਲਦੀ ਹੈ ਟੈਕਨੋਲੋਜੀ ਨੇ ਐਜੂਕੇਸ਼ਨ ਨੂੰ ਬਹੁਤ ਜ਼ਿਆਦਾ ਇਨਫਲੁਐਂਸ ਕੀਤਾ ਹੈ ਜਿਵੇਂ ਆਪਾਂ ਕਰ ਸਕਦੇ ਹਾਂ ਕਿ ਕਹਿ ਸਕਦੇ ਹਾਂ ਜਿਵੇਂ ਨਿਊਜ਼ ਚੈਨਲ ਹੋ ਗਏ ਜ ਵੱਖ ਵੱਖ ਨਿਊਜ਼ ਚੈਨਲਾਂ ਤੋਂ ਸਾਨੂੰ ਕੀ ਕਰੰਟ ਅਫੇਅਰਸ ਦੇ ਬਾਰੇ ਪਤਾ ਲੱਗਦਾ ਹੈ ਸਾਨੂੰ ਪਤਾ ਲੱਗਦਾ ਕਿ ਅੱਜ ਕੱਲ੍ਹ ਕੀ ਹੋ ਰਿਹਾ ਹੈ ਕਿੱਥੇ ਕਿਹੜੀ ਘਟਨਾ ਵਾਪਰ ਰਹੀ ਹੈ ਕਿਹੜੇ ਦੇਸ਼ ਦੇ ਵਿੱਚ ਕੀ ਹੋ ਗਿਆ ਕਿਹੜੇ ਦੇਸ਼ ਦੇ ਵਿੱਚ ਕੀ ਹੋ ਗਿਆ ਕਿੱਥੇ ਕੀ ਘਟਨਾ ਵਾਪਰ ਗਈ ਕਿੱਥੇ ਕੋਈ ਬੰਬ ਉਹ ਬੰਬ ਧਮਾਕਾ ਹੋ ਗਿਆ ਕਿੱਥੇ ਕੋ ਕੁਛ ਹੋ ਗਿਆ ਇਹ ਸਾਰੀਆਂ ਚੀਜ਼ਾਂ ਸਾਨੂੰ ਕਿੱਥੋਂ ਪਤਾ ਲੱਗਦੀਆਂ ਨੇ ਨਿਊਜ਼ ਚੈਨਲ ਤੋਂ ਇ ਆਪਾਂ ਕਹਿ ਸਕਦੇ ਕਿ ਟੈਕਨੋਲੋਜੀ ਹੈ ਇਸ ਨੂੰ ਐਜੂਕੇਸ਼ਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਸਾਰੀਆਂ ਚੀਜ਼ਾਂ ਹੋ ਗਈਆ ਜਿਵੇਂ ਟੀ ਵੀ 'ਤੇ ਵੀ ਕਾਫੀ ਜਿਵੇਂ ਚੈਨਲਜ਼ ਆਉਂਦੇ ਨੇ ਐਜੂਕੇਸ਼ਨ ਨਾਲ ਰਿਲੇਟੀਡ ਵੀ ਚੱਲਦੇ ਨੇ ਤਾਂ ਇਸ ਕਰਕੇ ਆਪਾਂ ਇਹ ਚੀਜ਼ਾਂ ਕਹਿ ਸਕਦੇ ਹਾਂ ਥੈਂ